ਹੈਲੋ ਗੁਡ ਆਫਟਰਨ ਜੀ ਕੀ ਹਾਲ ਆ ਤੁਹਾਡਾ ਮੈਂ ਤੁਹਾਡੀ ਸ਼ੋਪਿੰਗ ਤੋਂ ਕੁਝ ਦਿਨ ਪਹਿਲਾਂ ਇੱਕ ਆਈਫੋਨ ਚਾਰਜਰ ਬੁੱਕ ਕੀਤਾ ਸੀ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਦੋ ਤਿੰਨ ਦਿਨਾਂ ਵਿੱਚ ਰਿਸੀਵ ਹੋ ਜਾਵੇਗਾ ਤੁਹਾਡਾ ਔਡਰ ਪਰ ਮੈਨੂੰ ਦੋ ਹਫ਼ਤੇ ਬਾਅਦ ਇਹ ਰਿਸੀਵ ਹੋ ਰਿਹਾ ਵਾ ਅਤੇ ਦੂਜੀ ਗੱਲ ਇਹ ਵਾ ਤੁਹਾਡਾ ਡਿਲੀਵਰੀ ਪਾਰਟਨਰ ਬਹੁਤ ਰੂਡ ਹੈ ਉਸਨੇ ਮੇਰੇ ਨਾਲ ਬਿਲਕੁਲ ਵਧੀਆ ਬਿਹੇਵ ਨਹੀਂ ਕੀਤਾ ਜਦੋਂ ਆਰਡਰ ਦੇ ਰਿਹਾ ਸੀ ਅਤੇ ਪੈਕਜਿੰਗ ਵੀ ਬਹੁਤ ਖ਼ਰਾਬ ਸੀਗੀ ਔਡਰ ਦੀ ਅਤੇ ਪ੍ਰੋਡਕਟ ਦੇਖਣ 'ਚ ਹੀ ਇੰਨਾਂ ਡੈਮੇਜ ਲੱਗ ਰਿਹਾ ਸੀਗਾ ਅਤੇ ਜਦੋਂ ਮੈਂ ਯੂਜ ਕੀਤਾ ਤਾਂ ਉਹ ਬਿਲਕੁਲ ਚੱਲ ਨਹੀਂ ਰਿਹਾ ਸੀ ਅਤੇ ਉਹ ਚਾਰਜਿੰਗ ਵੀ ਇੰਨੀ ਘੱਟ ਕਰ ਰਿਹਾ ਇੱਦਾਂ ਲੱਗ ਹੀ ਨਹੀਂ ਰਿਹਾ ਕਿ ਨਵਾਂ ਚਾਰਜਰ ਮੈਨੂੰ ਰਿਸੀਵ ਹੋਇਆ ਪਲੀਜ਼ ਮੇਰੀ ਇਹ ਅਪੀਲ ਆ ਤੁਹਾਨੂੰ ਕਿ ਮੈਨੂੰ ਚਾਰਜਰ ਰੀਪਲੇਸ ਕੀਤਾ ਜਾਵੇ ਜਾਂ ਮੈਨੂੰ ਨਵਾਂ ਚਾਰਜਰ ਦਿੱਤਾ ਮੈਂ ਤੁਹਾਡੇ ਦੁਕਾਨ ਦੋ ਦਿਨਾਂ ਬਾਅਦ ਆਵਾਂਗੀ ਅਤੇ ਮੈਨੂੰ ਚਾਰਜਰ ਚੇਂਜ ਕੀਤਾ ਜਾਵੇ ਧੰਨਵਾਦ